ਹਾਂਜੀ ਅਸੀਂ ਇੱਕੀਵੀਂ ਸਦੀ 'ਚ ਜੀ ਰਹੇ ਆਂ ਤੇ ਇੱਕੀਵੀਂ ਸਦੀ ਤੱਕ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਅਤੇ ਬਿਜਲੀ ਤੋਂ ਬਿਨਾਂ ਰਹਿਣਾ ਹੁਣ ਤਾਂ ਐਂ ਲੱਗਦਾ ਵੀ ਅਸੰਭਵ ਹੀ ਹੈ ਕਿਉਂਕੀ ਬਿਜਲੀ ਦੇ ਨਾਲ ਹੀ ਸਾਡਾ ਹਰ ਜਿਹੜਾ ਨਿਤ ਪ੍ਰਤੀ ਦਿਨ ਦਾ ਕੰਮ ਹੈ ਇਹ ਸਾਰਾ ਹੀ ਬਿਜਲੀ ਦੇ ਨਾਲ ਜੁੜਿਆ ਹੋਇਆ ਬਿਜਲੀ ਦੇ ਨਾਲ ਸਾਡੇ ਕੰਪਿਊਟਰ ਜੁੜੇ ਹੋਏ ਨੇ ਬਿਜਲੀ ਦੇ ਨਾਲ ਸਾਡੇ ਬਾਕੀ ਸਾਰੇ ਉਪਕਰਨ ਜੁੜੇ ਹੋਏ ਨੇ ਇਸ ਕਰਕੇ ਬਿਜਲੀ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ ਹੁਣ ਉਹ ਅਸੰਭਵ ਹੀ ਜਾਪਦੀ ਹੈ